ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਜੋ ਕਿ ਪਿੰਡਾਂ ਦੇ ਵਿੱਚ ਮੌਜੂਦ ਹੁੰਦੀਆਂ ਹਨ ਜਿਵੇਂ ਕਿ ਆਪਾਂ ਉਸ ਦੇ ਇੱਕ ਅੱਧੇ ਟੋਪਿਕ ਦੇ ਬਾਰੇ ਹੀ ਗੱਲ ਕਰਾਂਗੇ ਅੱਜ ਜਿਵੇਂ ਕਿ ਪਿੰਡਾਂ ਦੇ ਵਿੱਚ ਸਾਨੂੰ ਸਮੱਸਿਆਵਾਂ ਸਭ ਤੋਂ ਪਹਿਲੀ ਇਹ ਆਉਂਦੀ ਹੈ ਕਿ ਉੱਥੇ ਸਹੂਲਤਾਂ ਬਹੁਤ ਹੀ ਘੱਟ ਹੁੰਦੀਆਂ ਹਨ ਜਿਹਦੇ ਕਰਕੇ ਆਪਾਂ ਨੂੰ ਪਿੰਡਾਂ ਤੋਂ ਲੋਕ ਜ਼ਿਆਦਾਤਰ ਸ਼ਹਿਰ ਵੱਲ ਨੂੰ ਭੱਜਦੇ ਹਨ ਜਿਵੇਂ ਕਿ ਕੋਈ ਦਵਾਈ ਦੀ ਸਮੱਸਿਆ ਨਾ ਉਹ ਪਿੰਡਾਂ ਦੇ ਵਿੱਚ ਜ਼ਿਆਦਾਤਰ ਹੋਸਪਿਟਲ ਹੁੰਦਾ ਹੈ ਨਾ ਦਵਾਈ ਦਾ ਕੋਈ ਸਿਸਟਮ ਹੁੰਦਾ ਹੈ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਹਨ